ਪੰਜਾਬੀ ਭਾਸ਼ਾ ਜਿਹੜੀ ਆ ਉਹ ਪੰਜਾਬ ਵਿੱਚ ਬੋਲੀ ਜਾਣ ਵਾਲੀ ਸਭ ਤੋਂ ਪ੍ਰਮੁੱਖ ਭਾਸ਼ਾ ਮੰਨੀ ਜਾਂਦੀ ਆ ਅਤੇ ਇਹਨਾਂ ਹੋਰ ਭਾਸ਼ਾਵਾਂ ਵਾਂਗ ਹੀ ਕਾਫ਼ੀ ਜ਼ਿਆਦਾ ਇੰਪੋਰਟੈਂਸ ਜਿਹੜੀ ਅੱਜਕੱਲ੍ਹ ਵੱਧ ਰਹੀ ਹੈ ਜੇ ਤੁਸੀਂ ਵਿਦੇਸ਼ਾਂ ਵਿੱਚ ਜਾਓ ਅਤੇ ਮੈਂ ਖਾਸ ਕਰ ਕੈਨੇਡਾ ਦੀ ਗੱਲ ਕਰਨਾ ਚਾਹਵਾਂਗੀ ਕਿ ਕੈਨੇਡਾ ਦੇ ਵਿੱਚ ਏਅਰਪੋਰਟ ਦੇ ਉੱਤੇ ਵੀ ਤੁਸੀਂ ਜਦੋਂ ਉਹਨਾਂ ਦੇ ਰੂਟਸ ਵਗੈਰਾ ਦੱਸਣ ਵਾਲੇ ਸਲੋਗਨ ਲਿਖੇ ਹੁੰਦੇ ਨੇ ਉੱਥੇ ਪੰਜਾਬੀ ਭਾਸ਼ਾ ਵੀ ਉਹ ਇਸਤੇਮਾਲ ਕਰ ਰਹੇ ਨੇ ਅਤੇ ਜਿਹੜੀ ਪੰਜਾਬੀ ਭਾਸ਼ਾ ਉਹ ਅੱਜ ਕੱਲ੍ਹ ਕਾਫ਼ੀ ਜ਼ਿਆਦਾ ਜਿਹੜਾ ਇਹਦਾ ਰੁਝਾਨ ਵੱਧ ਰਿਹਾ ਈਵਨ ਸਿਰਫ਼ ਪੰਜਾਬ 'ਚ ਨਹੀਂ ਹੋਰ ਜ਼ਿਲ੍ਹਿਆਂ 'ਚ ਵੀ ਹ ਹੋਰ ਸਟੇਟਸ ਵਿੱਚ ਵੀ ਕੋ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪੰਜਾਬੀ ਭਾਸ਼ਾ ਸੁਣਨਾ ਬੋਲਣਾ ਪਸੰਦ ਕਰਦੇ ਨੇ ਜਿਵੇਂ ਆਪਾਂ ਦਿੱਲੀ ਵਾਲੀ ਸਾਈਡ 'ਤੇ ਜਾਈਏ ਜਾਂ ਗੁਜਰਾਤ ਵਾਲੀ ਸਾਈਡ 'ਤੇ ਜਾਈਏ ਉੱਥੇ ਵੀ ਪੰਜਾਬੀ ਭਾਸ਼ਾ ਨੂੰ ਕਾਫ਼ੀ ਮਹੱਤਵ ਦਿੱਤਾ ਜਾਂਦਾ ਹੈ ਅਤੇ ਉਹ ਕਾਫ਼ੀ ਚੰਗਾ ਸਮਝਦੇ ਨੇ ਇ ਇਸ ਭਾਸ਼ਾ ਨੂੰ ਅਤੇ ਇਹ ਜਿਹੜੀ ਆ ਇਹ ਨੈਸ਼ਨਲ ਲੈਵਲ ਦੇ ਉੱਤੇ ਤਾਂ ਮਤਲਬ ਗਰੋਅ ਕਰ ਹੀ ਰਹੀ ਹੈ ਇਹਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਕਾਫ਼ੀ ਪ੍ਰੋਗਰੈੱਸ ਹੋ ਰਹੀ ਹੈ ਅਤੇ ਆਪਣੇ ਆਪ 'ਚ ਇੱਕ ਵੱਖਰੀ ਜੀ ਹੀ ਭਾਸ਼ਾ ਹੈਗੀ ਆ ਇਹਨੂੰ ਮਤਲਬ ਬੋਲਣ ਦਾ ਆਪਣਾ ਵੱਖਰਾ ਹੀ ਸਵਾਦ ਹੁੰਦਾ ਕਿ ਵੀ ਹਾਂ ਸਾਨੂੰ ਮਤਲਬ ਵਧੀਆ ਲੱਗਦਾ ਕਿ ਆਪਾਂ ਪੰਜਾਬੀ ਭਾਸ਼ਾ ਵਿੱਚ ਗੱਲ ਕਰ ਰਹੇ ਹਾਂ ਜਾਂ ਸਾਹਮਣੇ ਵਾਲੇ ਨੂੰ ਆਪਣੀ ਲੈਂਗੁਏਜ ਵਿੱਚ ਮਤਲਬ ਪੰਜਾਬੀ ਭਾਸ਼ਾ ਵਿੱਚ ਸਮਝਾ ਰਹੇ ਹਾਂ ਉਹਨੂੰ ਉਹ ਸਾਨੂੰ ਸੁਣ ਰਿਹਾ ਈਵਨ ਅੱਜ ਕੱਲ੍ਹ ਲੋਕਾਂ ਨੂੰ ਪੰਜਾਬੀ ਭਾਸ਼ਾ ਸੁਣਨਾ ਵੀ ਬਹੁਤ ਪਸੰਦ ਹੈਗਾ ਵੈ